ਅਸੀਂ ਹੁਣੇ ਪਿੱਛੇ ਜਿਹੇ ਸ਼੍ਰੀਨਗਰ ਗਏ ਸੀਗੇ ਮੈਂ ਅਤੇ ਮੇਰੀ ਬੇਟੀ ਤਾਂ ਮੈਂ ਉੱਥੇ ਕਿਸੇ ਪ੍ਰੋਫੈਸਰ ਦੀ ਇੰਟਰਵਿਊ ਲੈਣ ਵਾਸਤੇ ਗਈ ਸੀਗੀ ਤਾਂ ਅਸੀਂ ਉੱਥੇ ਹੀ ਸ਼ਾਮ ਦੇ ਟਾਈਮ ਘੁੰਮਣ ਗਏ ਡਲ ਲੇਕ ਦੇ ਵਿੱਚ ਸ਼ਿਕਾਰੇ ਦੇ ਵਿੱਚ ਘੁੰਮ ਰਹੇ ਸੀ ਇੰਨੇ ਵਿੱਚ ਹੀ ਸੂਰਜ ਦੇ ਛਿਪਣ ਦਾ ਟਾਈਮ ਹੋ ਗਿਆ ਤਾਂ ਸੂਰਜ ਛਿਪਦਾ ਇਸ ਤਰ੍ਹਾਂ ਲੱਗਦਾ ਸੀਗਾ ਜਿਵੇਂ ਕਿ ਉਹ ਲੇਕ ਦੇ ਵਿੱਚ ਹੀ ਵੜ ਰਿਹਾ ਹੋਵੇ ਤਾਂ ਬੜਾ ਹੀ ਵਧੀਆ ਨਜ਼ਾਰਾ ਸੀਗਾ ਇਹ ਮੈਨੂੰ ਬਹੁਤ ਚੰਗਾ ਲੱਗਿਆ ਅਤੇ ਅਸੀਂ ਜਦੋਂ ਰਸਤੇ ਦੇ ਵਿੱਚ ਜਾ ਰਹੇ ਸੀਗੇ ਅਸੀਂ ਰਸਤੇ ਦੇ ਦੋਨੇਂ ਪਾਸੇ ਬ੍ਰਿਕਸ਼ ਰੁੱਖ ਹੁੰਦੇ ਹਨ ਜਾਂ ਇੱਕ ਪਾਸੇ ਨਦੀ ਹੈ ਇੱਕ ਪਾਸੇ ਰੁੱਖ ਹੈ ਤਾਂ ਉਹ ਰਸਤੇ 'ਤੇ ਜਾਂਦੇ ਜਾਂਦੇ ਅਸੀਂ ਬਹੁਤ ਤਸਵੀਰਾਂ ਕਲਿੱਕ ਕਰਦੇ ਹਾਂ ਅਤੇ ਅਸੀਂ ਇਹਨਾਂ ਤਸਵੀਰਾਂ ਨੂੰ ਆਪਣੇ ਸਟੇਟਸ 'ਤੇ ਵੀ ਲਾ ਲੈਂਦੇ ਹਾਂ ਅਤੇ ਇਹਨਾਂ ਨੂੰ ਫੇਸਬੁਕ 'ਤੇ ਵੀ ਪੋਸਟ ਕਰ ਦਿੰਦੇ ਹਾਂ ਅਤੇ ਇਹਨਾਂ ਨੂੰ ਇੰਸਟਾਗਰਾਮ 'ਤੇ ਵੀ ਮੇਰੀ ਬੇਟੀ ਬਹੁਤ ਪਸੰਦ ਕਰਦੀ ਆ ਤਸਵੀਰਾਂ ਨੂੰ ਇੰਸਟਾਗਰਾਮ 'ਤੇ ਅਪਲੋਡ ਕਰਨਾ ਅਤੇ ਅਸੀਂ ਸਟੇਟਸ 'ਤੇ ਵੀ ਲਾ ਲੈਂਦੇ ਹਾਂ ਵਟਸਐਪ 'ਤੇ ਵੀ ਪੋਸਟ ਕਰ ਦਿੰਦੇ ਹਾਂ